ਰਸਮ ਰਿਵਾਜ਼ ਰਹੂ ਰੀਤਾਂ ਅਤੇ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ ਸਧਰਾਂ 'ਤੇ ਦੀ ਤਰਜਮਾਨੀ ਕਰਦੇ ਹਨ ਭਾਈਚਾਰਕ ਜੀਵਾਂ ਦੇ ਜਨਮ ਮਰਨ 'ਤੇ ਵਿਆਹ ਸ਼ਾਦੀ ਇਹਨਾਂ ਦੇ ਅਸਲੀ ਰੂਪ ਸਾਹਮਣੇ ਆਉਂਦਾ ਹੈ ਰਸਮ ਰਿਵਾਜ਼ ਪੰਜਾਬ ਵਿੱਚ ਕਾਫੀ ਹੱਦ ਤੱਕ ਮੰਨੇ ਜਾਂਦੇ ਹਨ ਇਹ ਰਸਮਾਂ ਜਨਮ ਵੇਲੇ ਮਰਨ ਵੇਲੇ ਗਰਭ ਵੇਲੇ ਜਣੇਪੇ ਦੀਆਂ ਰਸਮਾਂ ਗੁੜ੍ਹਤੀ ਦੀਆਂ ਰਸਮਾਂ ਆਮ ਤੌਰ 'ਤੇ ਮਨਾਈਆਂ ਜਾਂਦੀਆਂ ਹਨ ਜਦੋਂ ਇੱਕ ਔਰਤ ਗਰਭ ਧਾਰਨ ਧਾਰਨ ਕਰਦੀ ਹੈ ਉਦੋਂ ਪ ਪੰਜਾਬ ਵਿੱਚ ਗੋਦ ਭਰਾਈ ਦੀ ਰਸਮ ਕਾਫੀ ਮਸ਼ਹੂਰ ਹੈ ਅਤੇ ਪਹਿਲੇ ਸਮੇਂ ਵਿੱਚ ਪ੍ਰੇਤਾਂ ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ ਪੰਜਵੇਂ ਜਾਂ ਸੱਤਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਬੰਨ੍ਹਿਆ ਜਾਂਦਾ ਸੀ ਉਸ ਨੂੰ ਉਹ ਰਿਨ੍ਹ ਕੇ ਖਾਂਦੀ ਸੀ ਅਤੇ ਭਾਈਚਾਰੇ ਵਿੱਚ ਵੰਡਦੀ ਸੀ ਇਹ ਸੁਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇਂ ਪਤੀ ਪਤਨੀ ਪਤਨੀ ਦੇ ਸਹੁਰਿਆਂ ਵੱਲੋਂ ਘੱਲੇ ਹੋਏ ਕੱਪੜੇ ਪਹਿਨ ਕੇ ਜਠੇਰਿਆਂ ਦੀਆਂ ਸਤੀਆਂ ਦੀ ਪੂਜਾ ਕਰੀ ਜਾਂਦੀ ਸੀ ਜਣੇਪੇ ਦੀ ਰਸਮ ਵਿੱਚ ਜਣੇਪੇ ਤੋਂ ਪਿੱਛੋਂ ਬੱਚਾ ਅਤੇ ਜੱਚਾ ਨੂੰ ਧੂਫ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਤਾਂ ਜੋ ਬੁਰੀ ਨਜ਼ਰ ਤੋਂ ਬਚਾਇਆ ਜਾ ਸਕੇ ਜਦੋਂ ਨਵਜੰਮਾ ਬੱਚਾ ਜੰਮਿਆ ਜਾਂਦਾ ਹੈ ਤਾਂ ਉਹਨੂੰ ਗੁੜ੍ਹਤੀ ਦਿੱਤੀ ਜਾਂਦੀ ਸੀ ਸਾਡੇ ਸਿੱਖ ਧਰਮ ਵਿੱਚ ਗੁੜ੍ਹਤੀ ਜਿਵੇਂ ਇਹ ਪਤਾਸੇ ਘੋਲ ਕੇ ਬੱਚੇ ਦੇ ਮੂੰਹ ਵਿੱਚ ਪੰਜ ਬੂੰਦਾਂ ਪਾਈਆਂ ਜਾਂਦੀਆਂ ਨੇ ਇਸ ਤਰ੍ਹਾਂ ਬੱਚੇ ਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ ਅਤੇ ਜਣੇਪੇ ਤੋਂ ਪੰਜ ਦਿਨਾਂ ਬਾਅਦ ਪੰਜਵੀਂ ਨਹਾਉਣ ਦੀ ਰੀਤੀ ਹੈ ਪੰਜਵੇਂ ਦਿਨ ਮਾਵਾਂ ਪਾਣੀ ਵਿੱਚ ਸਿੰਜੀ ਮੇਥੀ ਜਾਂ ਬਣਦੇ ਪੱਤੇ ਉਬਾਲ ਕੇ ਨਹਾਉਦੀਆਂ ਹਨ ਅਤੇ ਇਸਨੂੰ ਪੰਜਵੀਂ ਨਾਹੀ ਕਿਹਾ ਜਾਂਦਾ ਹੈ ਪੰਜਵੀਂ ਨਾਹੀ ਦਾਈ ਕਰਵਾਉਂਦੀ ਹੈ ਨਹਾਉਣ ਤੋਂ ਪਹਿਲਾ ਉਹ ਮਾਂ ਦੀਆਂ ਤਲੀਆਂ ਥੱਲੇ ਕੁਝ ਨਗਦੀ ਰੱਖ ਰਖਾ ਲੈਂਦੀ ਸੀ ਜੋ ਬਾਅਦ ਵਿਚ ਦਾਈ ਨੂੰ ਦਿਤੀ ਜਾਂਦੀ ਹੈ ਅਤੇ ਛੇਵੇਂ ਦਿਨ ਸਚੋਂਕ ਪੂਰਾ ਕਰਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ ਪੰਜਾਬ ਵਿੱਚ ਇਹਨੂੰ ਛਟੀ ਕਹਿੰਦੇ ਹਨ ਇਸ ਵੇਲੇ ਮਾਂ ਰੱਜ ਕੇ ਖਾਂਦੀ ਸੀ ਵਿਸ਼ਵਾਸ ਕੀਤਾ ਜਾਂਦਾ ਹੈ ਵੀ ਜਿਹੜੀ ਜਿੰਨਾ ਨੀਤ ਭਰ ਕੇ ਖਾਊਗੀ ਉਨਾ ਹੀ ਬੱਚੇ ਨੀਤ ਭਰ ਕੇ ਆਊਗੀ ਬਾਹਰ ਵਧਾਇਆ ਜਾਂਦਾ ਹੈ ਇੱਕ ਰਸਮ ਹੈ ਪੰਜਾਬ ਵਿੱਚ ਤਾਂ ਜੋ ਬਾਹਰ ਤੇਰਵੇਂ ਦਿਨ ਜਿਹੜੀ ਜਣੇਪੇ ਤੋਂ ਤੇਰਵੇਂ ਦਿਨ ਬਾਅਦ ਅਤੇ ਉਹਨੂੰ ਬਾਹਰ ਵਧਾਏ ਮੁੰਡੇ ਦੀ ਮੁੰਡਾ ਹੋਵੇ ਤਾਂ ਸਾਰੇ ਹੀ ਲਾਗੀ ਨੂੰ ਆਸ ਪਾਸ ਰਿਸ਼ਤੇਦਾਰ ਸਾਡੇ ਤੋਹਫੇ ਲੈ ਕੇ ਆਉਂਦੇ ਹਨ ਸ਼ਾਮ ਨੂੰ ਬੱਚੇ ਦੀ ਮਾਂ ਜਣੇਪੇ ਵਿੱਚੋਂ ਪਹਿਲੀ ਵਾਰ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਅਤੇ ਬਾਹਰੋਂ ਚੰਗੇ ਸ਼ਗਨ ਵਾਸਤੇ ਉਹ ਹਰਾ ਘਾਹ ਪੁੱਟ ਕੇ ਜਿਹਨੂੰ ਇਹ ਥੁਕ ਕਹਿੰਦੇ ਹਨ ਖੱਬਲ ਘਾਹ ਪੱਟ ਕੇ ਲਿਆਉਂਦੀ ਹੈ ਅਤੇ ਭੇਲੀ ਮਤਲਬ ਭੇਲੀ ਮੁੰਡਾ ਹੋਵੇ ਤਾਂ ਬਹੁਤੀ ਥਾਈਂ ਇਸੇ ਦਿਆ ਦਾਦਕਿਆਂ ਨੂੰ ਨਾਈ ਦੇ ਹੱਥ ਦੱਬ ਖੰਮ੍ਹਣੀ ਅਤੇ ਗੁੜ ਦੀ ਭੇਲੀ ਭੇਜਦੇ ਸਨ ਛੂਛਕ ਹੁੰਦਾ ਛੂਛਕ ਨਾਨਕਿਆਂ ਵਲੋਂ ਭੇਜਣ ਦਾ ਰਿਵਾਜ਼ ਹੁੰਦਾ ਮਤਲਬ ਜਿਵੇਂ ਪੰਜੀਰੀ ਲੈ ਕੇ ਨਾਨਕੇ ਆਉਂਦੇ ਹਨ ਤਾਂ ਉਹ ਜਣੇਪੇ ਨਵਜੰਮੇ ਬੱਚੇ ਦੌਰਾਨ ਉਹ ਬੱਚੇ ਦੀ ਮਾਂ ਨੂੰ ਦਿੱਤੀ ਜਾਂਦੀ ਹੈ ਅਤੇ ਨਾਮ ਸੰਸਕਾਰ ਸਾਡੇ ਸਿੱਖ ਧਰਮ ਵਿੱਚ ਨਾਮ ਦੀ ਜਿਹੜਾ ਨਾਮਕਰਨ ਹੈ ਉਹ ਗੁਰੂ ਗ੍ਰੰਥ ਸਾਹਿਬ ਹੁਕਮਨਾਮੇ ਦਾ ਪਹਿਲਾ ਅੱਖਰ ਜਾਂ ਆਖਰੀ ਅੱਖਰ ਦੌਰਾਨ ਨਾਮ ਰੱਖਿਆ ਜਾਂਦਾ ਹੈ